ਮੇਰੇ ਦੁਆਰਾ ਪੜ੍ਹੀ ਗਈ ਆਖਰੀ ਕਿਤਾਬ ਜੋ ਮੈਨੂੰ ਯਾਦ ਆ ਰਹੀ ਹੈ ਅਪਸਰਾ ਹੈ ਅਪਸਰਾ ਕਿਤਾਬ ਦੋ ਹਜ਼ਾਰ ਤੇਈ ਵਿੱਚ ਲਿਖੀ ਗਈ ਹੈ ਅਤੇ ਇਹ ਪ੍ਰੀਤ ਕੈਂਥ ਦੁਆਰਾ ਲਿਖੀ ਗਈ ਕਿਤਾਬ ਹੈ ਇਸ ਕਿਤਾਬ ਦੇ ਵਿੱਚ ਜਿਹੜਾ ਕਿ ਇਕ ਇਸਤਰੀ ਦਾ ਸ਼ੋਸ਼ਣ ਦਿਖਾਇਆ ਗਿਆ ਹੈ ਉਸ ਔਰਤ ਦਾ ਹਰ ਜਗ੍ਹਾ 'ਤੇ ਸ਼ੋਸ਼ਣ ਹੋ ਰਿਹਾ ਹੈ ਪਹਿਲਾਂ ਜਦ ਜਦੋਂ ਉਸ ਦੇ ਪਤੀ ਨਾਲ ਉਸ ਦਾ ਵਿਆਹ ਹੁੰਦਾ ਹੈ ਤਾਂ ਇਸ ਤੋਂ ਬਾਅਦ ਉਹ ਵਿਦੇਸ਼ ਚਲਾ ਜਾਂਦਾ ਹੈ ਵਿਦੇਸ਼ ਜਾਣ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਨਾਲ ਨਹੀਂ ਲੈ ਕੇ ਜਾਂਦਾ ਤਾਂ ਇਸ ਪ੍ਰਕਾਰ ਉਸ ਦੀ ਪਤਨੀ ਉਸ ਤੋਂ ਬਿਨਾਂ ਉਸ ਦੇ ਬਿਰਹਾ ਵਿੱਚ ਰਹਿੰਦੀ ਹੈ ਪਰ ਫਿਰ ਕਿਵੇਂ ਨਾ ਕਿਵੇਂ ਕਰਕੇ ਉਹ ਵਿਦੇਸ਼ ਚਲੀ ਜਾਂਦੀ ਹੈ ਉਸ ਦਾ ਸਹੁਰਾ ਪਰਿਵਾਰ ਵਿਦੇਸ਼ ਹੈ ਉਸ ਦਾ ਪਤੀ ਵਿਦੇਸ਼ ਹੈ ਲੇਕਿਨ ਸਹੁਰੇ ਪਰਿਵਾਰ ਵੱਲੋਂ ਉਸ ਦਾ ਅਪਮਾਨ ਕੀਤਾ ਜਾਂਦਾ ਹੈ ਉਸ ਨੂੰ ਕੋਈ ਮਾਨ ਸਨਮਾਨ ਨਹੀਂ ਮਿਲਦਾ ਅੱਤਿਆਚਾਰ ਉਸ ਦੇ ਉੱਪਰ ਕੀਤੇ ਜਾਂਦੇ ਹਨ ਤਾਂ ਇਸ ਤੋਂ ਬਾਅਦ ਉਹ ਕਿਸੇ ਹੋਰ ਪੁਰਸ਼ ਦੇ ਸੰਪਰਕ ਵਿੱਚ ਆਉਂਦੀ ਹੈ ਕਿਸੇ ਗੈਰ ਪੁਰਸ਼ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਸ ਤੇ ਉਸ ਨਾਲ ਸੰਬੰਧ ਬਣਦੇ ਹਨ ਇੱਥੋਂ ਤੱਕ ਕਿ ਉਸ ਦੇ ਸਰੀਰਕ ਸਬੰਧ ਵੀ ਬਣ ਜਾਂਦੇ ਹਨ ਤਾਂ ਕਿਉਂਕਿ ਉਸ ਔਰਤ ਨੂੰ ਪਿਆਰ ਦੀ ਇੱਕ ਆਪਣੇਪਨ ਦੀ ਜ਼ਰੂਰਤ ਸੀ ਜੋ ਉਸ ਨੂੰ ਆਪਣੇ ਸਹੁਰੇ ਪਰਿਵਾਰ ਕੋਲੋਂ ਜਾਂ ਆਪਣੇ ਪਤੀ ਕੋਲੋਂ ਨਹੀਂ ਮਿਲਿਆ ਤਾਂ ਉਸ ਮਰਦ ਕੋਲੋਂ ਮਿਲਿਆ ਤਾਂ ਉਸ ਮਰਦ ਦੇ ਨਾਲ ਉਸ ਔਰਤ ਦੇ ਕੁਝ ਬੱਚੇ ਹੋ ਜਾਂਦੇ ਹਨ ਤਾਂ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹ ਪੁਰਸ਼ ਵੀ ਉਸ ਨੂੰ ਛੱਡ ਕੇ ਚਲਾ ਜਾਂਦਾ ਹੈ ਇਸ ਪ੍ਰਕਾਰ ਉਹ ਔਰਤ ਆਪਣੇ ਜੀਵਨ ਵਿੱਚ ਇਕੱਲੀ ਰਹਿ ਜਾਂਦੀ ਹੈ ਇਕੱਲੀ ਆਪਣਾ ਦੁੱਖ ਸੁੱਖ ਸਭ ਭੋਗਦੀ ਹੈ ਆ ਆਪਣੀ ਜ਼ਿੰਦਗੀ ਦਾ ਅੰਤ ਉਸ ਨੇ ਇਕੱਲਿਆਂ ਦੇਖਿਆ ਇਕੱਲਿਆਂ ਬਤੀ ਬਤੀਤ ਕੀਤਾ ਹੁੰਦਾ ਹੈ ਤਾਂ ਇਸ ਪ੍ਰਕਾਰ ਇੱਕ ਔਰਤ ਦੀ ਜੋ ਸਾਡੇ ਸਮਾਜ ਵਿੱਚ ਸਥਿਤੀ ਹੈ ਪੁਰਸ਼ ਵਰਗ ਕਿਵੇਂ ਉਸ ਨੂੰ ਆਪਣੇ ਪੈਰਾਂ ਹੇਠਾਂ ਲਿਤਾੜ ਰਿਹਾ ਹੈ ਉਹ ਅਪਸਰਾ ਕਿਤਾਬ ਦੇ ਵਿੱਚ ਦਿਖਾਈ ਗਈ ਹੈ